ਸਤਿ ਸ਼੍ਰੀ ਅਕਾਲ ਜੀ ਮੈਂ ਰਿਤੂ ਬਾਲਾ ਢ਼ੇਸਿਆਂ ਤੋਂ ਅਸੀਂ ਬਚਪਨ ਵਿੱਚ ਖੇਡਾਂ ਖੇਡਦੇ ਸੀ ਬੱਚਿਆਂ ਨਾਲ ਰਲ ਮਿਲ ਕੇ ਸਾਰੇ ਜਾਣੇ ਖੇਡਦੇ ਸੀ ਜਿੱਦਾਂ ਜਿੱਦਾਂ ਹੋ ਗਿਆ ਖੋ ਖੋ ਖੇਡਦੇ ਸੀ ਫਿਰ ਕੋਲ ਕਲਾਸੀ ਪਾਸੀ ਜ਼ਿੰਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਹੈ ਇਹ ਵਾਲੀ ਖੇਡ ਖੇਡਦੇ ਸੀ ਫਿਰ ਉਹ ਖੇਡਦੇ ਸੀ ਭੰਡੁਆ ਭੰਡਾਰੀਆ ਇਕ ਮੁੱਠ ਚੁੱਕ ਪਈ ਦੂਜੀ ਤਿਆਰ ਔਰ ਦੌੜਾਂ ਦੌੜਾਂ ਲਾਉਂਦੇ ਸੀ ਅਤੇ ਨਾਲੇ ਬਚਪਨ 'ਚ ਅਸੀਂ ਬੱਚਿਆਂ ਨਾਲ ਖੋ ਖੋ ਖੇਡਦੇ ਸੀ ਕਬੱਡੀ ਖੇਡਦੇ ਸੀ ਅਤੇ ਇਹੋ ਜਿਹੀਆਂ ਖੇਡਾਂ ਖੇਡਦੇ ਸੀ ਦੌੜਾਂ ਲਗਾਉਣਾ ਲੁਕਣ ਮਿਟਾਈ ਲੁਕਣ ਮਿਟਾਈ ਖੇਡਦੇ ਸੀ ਅਤੇ ਊਚ ਨੀਚ ਖੇਡਦੇ ਸੀ ਬੱਚਿਆਂ ਨਾਲ ਸਾਨੂੰ ਬੜਾ ਮਜ਼ਾ ਆਉਂਦਾ ਸੀ ਖੇਡ ਕੇ ਹੁਣ ਅਸੀਂ ਛੋਟੇ ਹੁੰਦੇ ਇਹੋ ਜਿਹੀਆਂ ਦੌੜਾਂ ਖੇਡਾਂ ਖੇਡਦੇ ਸੀ ਅਤੇ ਹੁਣ ਸਾਨੂੰ ਬੱਚਿਆਂ ਦੀ ਯਾਦ ਆਉਂਦੀ ਹੈ ਬਚਪਨ ਦੀ ਯਾਦ ਆਉਂਦੀ ਹੈ ਬਚਪਨ 'ਚ ਖੇਡਦੇ ਸੀ ਠੀਕ ਹੈ